ਮੇਰੀ ਕੋਲੇਜ ਦੀ ਇੱਕ ਫਰੈਂਡ ਹੈ ਜਿਸਦੇ ਘਰ ਦੇ ਜੋ ਨੇ ਉਹ ਇੱਕ ਨਵਾਂ ਘਰ ਬਣਾਉਣ ਦੀ ਸ਼ੁਰੂਆਤ ਕਰ ਚੁੱਕੇ ਨੇ ਉਹਨਾਂ ਨੇ ਪਹਿਲਾਂ ਇੱਕ ਪਲੋਟ ਖਰੀਦਿਆ ਜਿਸ ਵਿੱਚ ਉਹਨਾਂ ਨੇ ਆਪਣੇ ਪੁਰਾਣੀ ਕੀਤੀ ਹੋਈ ਸੇਵਿੰਗਸ ਜੋ ਨੇ ਉਹ ਯੂਜ ਕੀਤੀਆਂ ਅਤੇ ਐਫ ਡੀਜ ਤੁੜਵਾਈਆਂ ਅਤੇ ਹੁਣ ਉਹਨਾਂ ਨੇ ਕੰਸਟਰਕਸ਼ਨ ਸਟਾਰਟ ਕਰ ਦਿੱਤੀ ਹੈ ਅਤੇ ਕੰਸਟਰਕਸ਼ਨ ਦਾ ਕੰਮ ਅੱਧ ਵਿਚਾਲੇ ਤੱਕ ਪਹੁੰਚ ਗਿਆ ਹੈ ਪਰ ਹੁਣ ਉਹਨਾਂ ਉਹਨਾਂ ਨੂੰ ਫੰਡਸ ਦੀ ਦਿੱਕਤ ਆ ਰਹੀ ਹੈ ਅਤੇ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਅੱਗੇ ਪੈਸੇ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਮੈਂ ਆਪਣੀ ਫਰੈਂਡ ਨੂੰ ਹੋਮ ਲੋਨ ਬਾਰੇ ਸਲਾਹ ਦਿੱਤੀ ਕਿ ਉਹ ਬੈਂਕ ਆਪਣੇ ਪੇਰ ਘਰਦਿਆਂ ਨੂੰ ਜਾ ਕੇ ਕਹੇ ਕਿ ਉਹ ਬੈਂਕ ਤੋਂ ਹੋਮ ਲੋਨ ਲੈ ਲੈਣ ਹੋਮ ਲੋਨ ਲੈਣ ਦੇ ਕਈ ਸਾਰੇ ਫਾਇਦੇ ਨੇ ਉਹਨਾਂ ਨੂੰ ਹੋਮ ਲੋਨ ਚੁਕਾਉਣ ਲਈ ਵੀ ਪੰਜ ਤੋਂ ਦਸ ਸਾਲ ਦਾ ਸਮੇਂ ਆਰਾਮ ਨਾਲ ਮਿਲ ਜਾਂਦਾ ਹੈ ਜਿਸ ਵਿੱਚ ਉਹ ਆਰਾਮ ਨਾਲ ਹੋਮ ਲੋਨ ਚੁਕਾ ਸਕਦੇ ਨੇ ਅਤੇ ਉਸਦੇ ਮਾਤਾ ਪਿਤਾ ਦੋਨੋਂ ਹੀ ਵਰਕਿੰਗ ਨੇ ਇਮਪਲੋਈਜ਼ ਨੇ ਉਹਨਾਂ ਦੋਨਾਂ ਦੀ ਸੈਲਰੀ ਦੇ ਬੇਸ 'ਤੇ ਉਹਨਾਂ ਨੂੰ ਹੋਮ ਲੋਨ ਲੈਣ ਵਿੱਚ ਵੀ ਆਸਾਨੀ ਹੋਵੇਗੀ ਹੋਮ ਲੋਨ ਲੈ ਕੇ ਉਹ ਆਪਣੇ ਘਰ ਦੀ ਕੰਸਟਰਕਸ਼ਨ ਜੋ ਹੈ ਉਸ ਦੀ ਦੁਬਾਰਾ ਤੋਂ ਸ਼ੁਰੂਆਤ ਕਰਕੇ ਉਸ ਘਰ ਨੂੰ ਪੂਰੀ ਤਰ੍ਹਾਂ ਬਣਾ ਸਕਦੇ ਨੇ